ਵੈਸੇ ਤਾਂ ਕਈ ਸਰਕਾਰੀ ਐਪ ਨੇ ਜਿਹਦੀ ਯੂਜ਼ ਅਸੀਂ ਕਰਦੇ ਹੈ ਲੇਕਿਨ ਸਭ ਤੋਂ ਜ਼ਿਆਦਾ ਮੈਂ ਡਿਜੀਲੋਕਰ ਦਾ ਯੂਜ਼ ਕਰਦਾ ਆ ਜਿਹਦੇ ਵਿੱਚ ਮੇਰੇ ਡੋਕੂਮੈਂਟਸ ਸੇਫ ਸੇਫ ਪਏ ਨੇ ਅਤੇ ਕਈ ਵਾਰ ਅਸੀਂ ਜਾਂਦੇ ਹਾਂ ਤਾਂ ਸਾਡੇ ਜੇਬ ਵਿੱਚ ਉਹ ਨਹੀਂ ਹੁੰਦੇ ਡੋਕੂਮੈਂਟ ਅਤੇ ਗੋਰਮੈਂਟ ਨੇ ਇੰਨੀ ਸੁਵਿਧਾ ਦੇ ਦਿੱਤੀ ਵੀ ਹੈ ਜਿੱਦਾਂ ਹੁਣ ਕੋਈ ਟ੍ਰੈਫਿਕ ਪੁਲਿਸ ਵਾਲ਼ਾ ਸਾਨੂੰ ਰੋਕਦਾ ਏ ਅਤੇ ਸਾਡੇ ਕੋਲ ਡਰਾਈਵਿੰਗ ਲਾਈਸੈਂਸ ਨਹੀਂ ਹੈ ਤਾਂ ਇੱਕ ਸੈਕਿੰਡ ਵਿੱਚ ਮੈਂ ਡਿਜੀਲੋਕਰ 'ਚੋਂ ਖੋਲ ਕੇ ਉਹਨਾਂ ਨੂੰ ਦਿਖਾ ਦਿੰਦਾ ਹਾਂ ਤਾਂ ਇਹ ਸਰਕਾਰੀ ਐਪਸ ਵਿੱਚ ਮੈਂ ਜ਼ਿਆਦਾਤਰ ਤਾਂ ਡਿਜੀਲੋਕਰ ਦੀ ਕਰਦਾ ਐਂ ਅਤੇ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਤੁਹਾਡੇ ਮਾਰਕਸ਼ੀਟਸ ਡਰਾਈਵਿੰਗ ਲਾਈਸੈਂਸ ਆਧਾਰ ਕਾਰਡ ਕਈ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਯੂਜ਼ 'ਚ ਆਉਂਦੀਆਂ ਜਿਹੜੀਆਂ ਤੁਹਾਡੇ ਜੇਬ 'ਚ ਨਾ ਹੋਣ ਕਾਰਨ ਵੀ ਤੁਸੀਂ ਉਸਨੂੰ ਯੂਜ਼ ਕਰ ਸਕਦੇ ਹੋ ਡਿਜ਼ੀਟਲੀ ਰੂਪ ਵਿੱਚ ਫ਼ਿਰ ਟੈਕਨੋਲਜੀ ਯਾਨੀ ਕਿ ਇੱਥੇ ਸਾਡੀ ਬਹੁਤ ਹੈਲਪ ਕਰਦੀ ਹੈ ਅਤੇ ਸਰਕਾਰ ਦੀ ਇਹ ਐਪ ਬਹੁਤ ਵਧੀਆ ਹੈ